ਭਾਰਤ ਵਿੱਚ ਬਹੁਤ ਸਾਰੀਆਂ ਖੇਡਾਂ ਪ੍ਰਸਿੱਧ ਵਾ ਜਿਹਨਾਂ ਵਿੱਚੋਂ ਕੁਝ ਕੁ ਹੈਗੀਆਂ ਜਿਸ ਤਰ੍ਹਾਂ ਹਾਕੀ ਬੈਡਮਿੰਟਨ ਟੈਨਿਸ ਜਾਂ ਕ੍ਰਿਕਟ ਅਤੇ ਦੇਸ਼ ਦੇ ਸਭ ਤੋਂ ਮਸ਼ਹੂਰ ਅਥਲੀਟ ਜਿਹੜੇ ਓ ਉਹ ਮਿਲਖਾ ਸਿੰਘ ਆ ਅਤੇ ਉਹ ਮੈਨੂੰ ਜਿਹੜੇ ਉਹ ਬਹੁਤ ਹੀ ਪਸੰਦ ਵਾ